ਅਸੀਂ ਪੰਛੀ ਵੇਖਣ ਵੇਲੇ ਬਰਡ ਫੋਟੋਗ੍ਰਾਫੀ ਦੀ ਕੋਸ਼ਿਸ਼ ਕੀਤੀ ਹੈ ਸਾਡੇ ਸਾਹਮਣੇ ਇੱਕ ਘਰ ਹੈ ਉਹ ਪੰਛੀ ਪਾਲਦੇ ਹਨ ਉਹਨਾਂ ਦੇ ਕੋਲ ਹਰ ਤਰ੍ਹਾਂ ਦੇ ਪੰਛੀ ਹਨ ਉਹ ਉਹਨਾਂ ਨੂੰ ਧੁੱਪ ਵਿੱਚ ਖੁਰਾਕ ਪਾ ਜਾਂਦੇ ਹਨ ਅਸੀਂ ਉੱਪਰ ਜਾਂਦੇ ਹਾਂ ਤਾਂ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਾਂ ਮੇਰਾ ਮਨ ਕਰਦਾ ਹੈ ਅਸੀਂ ਵੀ ਆਪਣੇ ਘਰ ਕੁਛ ਪੰਛੀ ਰੱਖੀਏ ਪੰਛੀ ਰੱਖਣ ਨਾਲ ਅਸੀਂ ਉਹਨਾਂ ਨੂੰ ਜਦੋਂ ਚੋਗਾ ਪਾਉਂਦੇ ਹਾਂ ਤਾਂ ਉਹ ਸਾਨੂੰ ਕਈ ਦੁਆਵਾਂ ਦਿੰਦੇ ਹਨ ਮੈਂ ਉੱਪਰ ਪੰਛੀਆਂ ਦੀ ਫੋਟੋਗ੍ਰਾਫੀ ਕਰਦੀ ਹਾਂ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਫੋਟੋ ਖਿੱਚਦੀ ਹਾਂ ਸਾਨੂੰ ਪੰਛੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਪੰਛੀ ਸਾਡੇ ਜੀਵਨ ਵਿੱਚ ਬਹੁਤ ਹੀ ਵਧੀਆ ਹੁੰਦੇ ਹਨ ਅਸੀਂ ਅਗਰ ਉਹਨਾਂ ਨੂੰ ਪਿਆਰ ਕਰੀਏ ਤਾਂ ਉਹ ਸਾਨੂੰ ਬਹੁਤ ਪਿਆਰ ਕਰਦੇ ਹਨ ਇਸ ਲਈ ਪੰਛੀਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਫੋਟੋਆਂ ਵੀ ਕਲਿੱਕ ਕਰਨੀਆਂ ਚਾਹੀਦੀਆਂ ਹਨ ਪੰਛੀ ਹੀ ਸਾਨੂੰ ਖਾਣਾ ਦਾਣਾ ਵਗੈਰਾ ਦਿੰਦੇ ਹਨ